ਮੇਰੇ ਭਤੀਜੇ ਨੇ ਨਾ ਇੱਕ ਘੜੀ ਮੰਗਵਾਈ ਸੀ ਉਹ ਮੈਨੂੰ ਗਿਫਟ ਕੀਤੀ ਸੀ ਬਹੁਤ ਸੋਹਣੀ ਸੀ ਮੇਰਾ ਖਿਆਲ ਐਚ ਟੀ ਐਮ ਕੰਪਨੀ ਦੀ ਸੀ ਅਤੇ ਟਾਈਮ ਵੀ ਦੱਸਦੀ ਸੀ ਉਹ ਡੇਟ ਵੀ ਦੱਸਦੀ ਸੀ ਦਿਨ ਵੀ ਦੱਸਦੀ ਸੀ ਹੋ ਗਏ ਚਾਰ ਪੰਜ ਸਾਲ ਮੰਗਵਾਏ ਨੂੰ ਬੜਾ ਸਮਾਂ ਹੋ ਗਿਆ ਚੱਲਦੀ ਨੂੰ ਉਹਨੂੰ ਘੜੀ ਬਹੁਤ ਸੋਹਣੀ ਸੀਗੀ ਅਤੇ ਜਿਹੜੀ ਘੜੀ ਹੈ ਬੜਾ ਸਮਾਂ ਚੱਲੀ ਆ ਬਹੁਤ ਪੰਜ ਸਾਲ ਹੋ ਗਏ ਐਚ ਟੀ ਐਮ ਦੀ ਅਤੇ ਉਹਦੇ 'ਚ ਕੋਈ ਦਿੱਕਤ ਵੀ ਨਹੀਂ ਆਈ ਅੱਜ ਤੱਕ ਖਰਾਬ ਵੀ ਨਹੀਂ ਹੋਈ ਕੋਈ ਖਰਾਬੀ ਨਹੀਂ ਉਹ 'ਚ ਹੋਈ ਅੱਜ ਤੱਕ ਪਾਣੀ 'ਚ ਵੀ ਬਹੁਤ ਵਾਰ ਡਿੱਗ ਪਈ ਅੱਜ ਵੀ ਉਹ 'ਚ ਕੋਈ ਖਰਾਬੀ ਨਹੀਂ ਆਈ ਪਾਣੀ 'ਚ ਡਿੱਗਣ ਕਾਰਨ ਕੋਈ ਖਰਾਬੀ ਨਹੀਂ ਆਈ ਉਹ 'ਚ ਸਸਤੀ ਵੀ ਸੀ ਅਤੇ ਨਾਲ ਸੋਹਣੀ ਬਹੁਤ ਸੀ ਅਤੇ ਉਹਦਾ ਜਿਹੜਾ ਰੰਗ ਆ ਉਹ ਵੀ ਨਹੀਂ ਅਜੇ ਤੱਕ ਫੇਂਟ ਹੋਇਆ ਅਤੇ ਹਲਕੀ ਵੀ ਬੜੀ ਹੈ ਅਤੇ ਹੱਥ 'ਚ ਪਾਈ ਸੋਹਣੀ ਵੀ ਬੜੀ ਲੱਗਦੀ ਹੈ ਮੈਨੂੰ ਬਹੁਤ ਪਸੰਦ ਆਈ ਬਹੁਤ ਵਧੀਆ ਲੱਗੀ ਉਹ